ਜੇਕਰ ਤੁਸੀਂ ਇੱਕ ਘਰ ਦੇ ਮਾਲਿਕ ਹੋ ਜੋ ਆਪਣੇ ਘਰ ਨੂੰ ਵਧੇਰੇ ਊਰਜਾ ਕੁਸ਼ਲ ਬਣਾਉਣਾ ਆਪਣੇ ਕਾਰਬਨ ਫੁੱਟ ਪ੍ਰਿੰਟ ਨੂੰ ਘਟਾਉਣਾ ਅਤੇ ਪੈਸੇ ਬਚਾਉਣਾ ਚਾਹੁੰਦੇ ਹੋ ਤਾਂ ਇੱਕ ਘਰੇਲੂ ਊਰਜਾ ਆਈਡਿਟ ਵਰਕਸ਼ੋਪ ਸ਼ੁਰੂ ਕਰਨ ਲਈ ਇੱਕ ਵਧੀਆ ਜਗ੍ਹਾ ਹੈ ਇਹ ਵਰਕਸ਼ਾਪਾਂ ਤੁਹਾਡੇ ਘਰ ਵਿੱਚ ਊਰਜਾ ਦੀਆਂ ਅਕੁਸ਼ਲਤਾਵਾਂ ਦੀ ਪਛਾਣ ਕਰਨ ਵਿੱਚ ਮਾਹਰ ਮਾਰਗਦਰਸ਼ਨ ਪ੍ਰਦਾਨ ਕਰਦੀਆਂ ਹਨ ਅਤੇ ਕੁਸ਼ਲਤਾ ਨੂੰ ਬਿਹਤਰ ਬਣਾਉਣ ਲਈ ਵਿਹਾਰ ਵਿਹਾਰਕ ਹੱਲ ਪੇਸ਼ ਕਰਦੀਆਂ ਹਨ ਇੱਕ ਵਰਕਸ਼ਾਪ ਵਿੱਚ ਸ਼ਾਮਿਲ ਹੋ ਕੇ ਤੁਸੀਂ ਸਿੱਖੋਗੇ ਕਿ ਹਵਾ ਦੇ ਲੀਨ ਦਾ ਪਤਾ ਕਿਵੇਂ ਲਗਾਉਣਾ ਹੈ ਇੰਸੂਲੇਸ਼ਨ ਗੁਣਵੱਤਾ ਅਤੇ ਮੁਲਾਂਕਣ ਕਿਵੇਂ ਕਰਨਾ ਹੈ ਅਤੇ ਆਪਣੇ ਘਰ ਦੇ ਊਰਜਾ ਖਪਤ ਦੇ ਪੈਟਰਨਾਂ ਕਿਵੇਂ ਸਮਝਣਾ ਹੈ ਇੰਸਟਰਕਚਰ ਲਾਗਤ ਪ੍ਰਭਾਵਸ਼ਾਲੀ ਅਪਗਰੇਡਾਂ ਬਾਰੇ ਸੂਝ ਪ੍ਰਦਾਨ ਕਰੇਗਾ ਜਿਵੇਂ ਕਿ ਦਰਵਾਜ਼ਿਆਂ ਅਤੇ ਖਿੜਕੀਆਂ ਦੇ ਆਲੇ ਦੁਆਲੇ ਪਾੜੇ ਨੂੰ ਸੀਲ ਕਰਨਾ ਇੰਸੋਲੇਸ਼ਨ ਨੂੰ ਅਪਗਰੇਡ ਕਰਨਾ ਐਲ ਈ ਡੀ ਲਾਈਟਿੰਗ ਦੇ ਸਵਿੱਚ ਕਾਰਨ ਅਤੇ ਹੀਟਿੰਗ ਅਤੇ ਕੂਲਿੰਗ ਨੂੰ ਅਨੁਕੂਲ ਬਣਾਉਣ ਲਈ ਸਮਾਰਟ ਥਰਮੋ ਸਿਸਟਮ ਦੀ ਵਰਤੋਂ ਕਰਨਾ ਇਸ ਤੋਂ ਇਲਾਵਾ ਉਹ ਇੱਕ ਨਿਧਾਰਨ ਨਿਰਧਾਰਿਤ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ ਕੀ ਕੀ ਸੋਲਰ ਪੈਨਲ ਦਾ ਊਰਜਾ ਕੁਸ਼ਲ ਉਪਕਰਨ ਤੁਹਾਡੇ ਘਰ ਦੀ ਢੁਕਵੇਂ ਹਨ ਧੰਨਵਾਦ